ਹੈਲੋ ਸਰ ਮੀਸ਼ੋ ਤੋਂ ਬੋਲਦੇ ਪਏ ਸਰ ਮੈਂ ਤੁਹਾਡੇ ਕੋਲੋਂ ਦੋ ਪ੍ਰੋਡਕਟ ਮੰਗਵਾਏ ਸੀ ਲਪਿਸਟਿਕ ਲੈਕਮੇ ਦੀ ਸੀ ਅਤੇ ਬਹੁਤ ਸੋਹਣਾ ਮੈਨੂੰ ਤੁਸੀਂ ਪਰੈ ਪ੍ਰੋਡਕਟ ਦਿੱਤਾ ਇਹਦਾ ਕਲਰ ਬਹੁਤ ਸੋਹਣਾ ਹੈ ਮਤਲਬ ਅਲੱਗ ਜਿਹੀ ਸ਼ੇਡ ਆ ਮਾਰਕੀਟ ਵਿੱਚ ਮੈਂ ਇਹਨੂੰ ਲੱਭਦੀ ਰਹੀ ਇਸ ਕਲਰ ਨੂੰ ਮੈਨੂੰ ਨਹੀਂ ਮਿਲੇ ਤਾਂ ਦੋਨੋਂ ਹੀ ਕਲਰ ਬਹੁਤ ਵਧੀਆ ਨੇ ਅਤੇ ਮੈਂ ਇਹਨਾਂ ਨੂੰ ਮੈਂ ਜਿਸ ਤਰ੍ਹਾਂ ਮੰਗਵਾਇਆ ਸੀ ਆਪਣੇ ਸੂਟਾਂ ਨਾਲ ਮੈਚ ਇਵੇਂ ਹੀ ਇਹ ਮੇਰੇ ਸੂਟਾਂ ਨਾਲ ਮੈਚ ਕਲਰ ਨੇ ਬਹੁਤ ਸੋਹਣੇ ਕਲਰ ਦਿੱਤੇ ਤੁਸੀਂ ਮੈਨੂੰ ਅਤੇ ਬਹੁਤ ਇਹਨਾਂ ਦਾ ਫਲੇਵਰ ਵੀ ਬਹੁਤ ਵਧੀਆ ਆ ਲਪਿਸ ਲਿਪਸ 'ਤੇ ਲਗਾਉਂਦਿਆਂ ਹੀ ਲਪਿਸ ਲਿਪਸ ਬਹੁਤ ਵਧੀਆ ਹੋ ਜਾਂਦੇ ਨੇ ਮੁਲਾਇਮ ਹੋ ਜਾਂਦੇ ਨੇ ਅਤੇ ਇਹਨਾਂ ਦਾ ਫਲੇਵਰ ਵੀ ਸਟੋਬੇਰੀ ਫਲੇਵਰ ਆ ਜਿਵੇਂ ਕਿ ਮੈਂ ਮੰਗਵਾਇਆ ਸੀ ਅਤੇ ਬਹੁਤ ਲੰਬਾ ਸਮਾਂ ਕੱਢਦੇ ਨੇ ਅਤੇ ਇਹਨਾਂ ਦੇ ਵਿੱਚੋਂ ਸਮੈਲ ਵੀ ਬਹੁਤ ਸੋਹਣੀ ਆਉਂਦੀ ਹੈ ਸਮੈਲ ਬਹੁਤ ਵਧੀਆ ਇਹਦੀ ਅਤੇ ਬੁੱਲ੍ਹਾਂ ਨੂੰ ਕੋਈ ਨੁਕਸਾਨ ਨਹੀਂ ਕਰਦੀ ਅਤੇ ਮੈਂ ਇਸ ਨੂੰ ਲਗਾ ਕੇ ਪਾਰਟੀ 'ਤੇ ਗਈ ਸੀ ਅਤੇ ਸਭ ਲੋਕ ਮੇਰੀ ਲਿਪਿਸਟਿਕ ਵੱਲ ਦੇਖਦੇ ਪਏ ਸੀ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਲਈ ਅਤੇ ਮੈਂ ਤੁਹਾਡੀ ਸਾਈਟ ਬਾਰੇ ਉਹਨਾਂ ਨੂੰ ਦੱਸ ਦਿੱਤਾ ਅਤੇ ਬਹੁਤ ਸੋਹਣਾ ਕਲਰ ਆ ਇਹਦਾ ਅਤੇ ਬਹੁਤ ਵਧੀਆ ਲਿਪਸ ਨੂੰ ਰੱਖਦੀਆਂ ਇਹ ਅਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਵਧੀਆ ਪ੍ਰੋਡੈਕਟ ਦਿੱਤਾ ਏ ਥੈਂਕ ਯੂ ਸਰ ਥੈਂਕ ਯੂ